ਹੈਲੋ ਅੱਛਾ ਜੀ ਕੋਈ ਗੱਲ ਨਹੀਂ ਜੀ ਅਸੀਂ ਦੱਸ ਦਿੰਦੇ ਹਾਂ ਅਸੀਂ ਵਨ ਵਿਭਾ ਵਨ ਵਿਭਾਗ ਵਾਲੇ ਬੋਲਦੇ ਹੈ ਤੁਸੀਂ ਕਿਸ ਚੀਜ਼ ਆ ਕਿਹੜੀ ਸਬਜ਼ੀ ਬਾਰੇ ਜਾਂ ਕਿਹੜੇ ਪੌਦਿਆਂ ਬਾਰੇ ਸਾਡੇ ਤੋਂ ਪੁੱਛਣਾ ਚਾਹੁੰਦੇ ਹੋ ਸਰਦੀ ਦੇ ਵਿੱਚ ਆਉਣ ਵਾਲੇ ਪੌਦਿਆਂ ਬਾਰੇ ਠੀਕ ਹੈ ਜੀ ਅਸੀਂ ਉਹਨਾਂ ਬਾਰੇ ਦੱਸ ਦਿੰਦੇ ਹਾਂ ਸਰਦੀ ਦੇ ਵਿੱਚ ਜਿਵੇਂ ਕਿ ਮਟਰ ਹੋ ਗਏ ਗਾਜਰ ਹੋ ਗਈ ਮੂਲੀ ਹੋ ਗਈ ਪਾਲਕ ਹੋ ਗਈ ਅਤੇ ਇੱਦਾਂ ਹੀ ਸਰ੍ਹੋਂ ਦਾ ਸਾਗ ਹੋ ਗਿਆ ਇਹੀ ਚੀਜ਼ਾਂ ਸਰਦੀ ਦੇ ਵਿੱਚ ਕਾਫੀ ਇਹ ਲਾਈਆਂ ਜਾਂਦੀਆਂ ਨੇ ਅਤੇ ਲੋਕ ਇਹਨਾਂ ਨੂੰ ਕਾਫੀ ਪਸੰਦ ਕਰਦੇ ਨੇ ਇਹ ਆਪਾਂ ਆਮ ਆਪਣੇ ਘਰਾਂ ਦੇ ਵਿੱਚ ਵੀ ਲਾ ਸਕਦੇ ਹੈ ਤੁਸੀਂ ਹੋਰ ਕੀ ਪੁੱਛਣਾ ਚਾਹੁੰਦੇ ਹੋ ਜੀ ਅੱਛਾ ਜੀ ਠੀਕ ਹੈ ਜੀ ਆਪਾਂ ਜਦੋਂ ਪੌਦਾ ਲਾਉਂਦੇ ਹਾਂ ਉਹਨਾਂ ਨੂੰ ਉਦੋਂ ਉਹਦੀ ਯਾਨੀ ਕਿ ਮਿੱਟੀ ਦੀ ਚੰਗੀ ਤਰ੍ਹਾਂ ਖੁਦਾਈ ਕਰਕੇ ਆਪਾਂ ਬੀਜ ਲਾ ਕੇ ਅਤੇ ਆਪਾਂ ਨੂੰ ਪੰਦਰ੍ਹਾਂ ਦਿਨਾਂ ਲਈ ਉਸ ਨੂੰ ਇੱਕ ਵਾਰੀ ਛੱਡ ਦੇਣਾ ਚਾਹੀਦਾ ਮਿੱਟੀ ਨੂੰ ਪੂਰਾ ਤੀਸਰੇ ਦਿਨ ਰੋਜ਼ ਦੀ ਰੋਜ਼ ਪਾਣੀ ਦੇ ਕੇ ਅਤੇ ਉਹਨੂੰ ਫਿਰ ਉਸ ਤੋਂ ਬਾਅਦ 'ਚ ਜਦੋਂ ਛੋਟੇ ਛੋਟੇ ਪੌਦੇ ਗ੍ਰੋਥ ਕਰਨ ਲਗਦੇ ਨੇ ਫਿਰ ਉਹ ਉਹਨਾਂ ਨੂੰ ਆਪਾਂ ਹੌਲੀ ਹੌਲੀ ਥੋੜ੍ਹੀ ਬਹੁਤੀ ਖਾਦ ਜਿੱਦਾਂ ਕਿ ਘਰੇ ਬਣਾਉਣੀ ਹੈ ਚਾਹ ਪੱਤੀ ਵਗੈਰਾ ਆਪਾਂ ਹੁੰਦੀ ਹੈ ਘਰਾਂ ਦੇ ਵਿੱਚ ਆਪਣੇ ਸਬਜ਼ੀਆਂ ਫਰੂਟ ਵਗੈਰਾ ਇਹਨਾਂ ਦੀਆਂ ਉਹਨਾਂ ਨੇ ਜਿਹੜੀ ਗਾ ਆਪਾਂ ਪ੍ਰੋਸ਼ੀਲਾ ਹੁੰਦੀਆਂ ਨੇ ਉਹਨਾਂ ਦੀ ਆਪਾਂ ਘਰੇ ਇੱਕ ਡੱਬੇ ਦੇ ਵਿੱਚ ਸਟੋਰ ਕਰਕੇ ਖਾਦ ਬਣਾ ਕੇ ਆਪਾਂ ਇਹ ਚੀਜ਼ਾਂ ਇਹਨਾਂ ਪੌਦਿਆਂ ਨੂੰ ਪਾ ਸਕਦੇ ਹਾਂ ਇਹਦੇ ਨਾਲ ਪੌਦੇ ਬੜੇ ਵਧੀਆ ਗਰੋਥ ਕਰਦੇ ਨੇ ਅਤੇ ਨਾਲੇ ਆਪਣੇ ਵਧੀਆ ਇਹ ਘਰੇ ਉਗਾਏ ਜਾਂਦੇ ਨੇ ਇਹਨਾਂ ਪੌਦਿਆਂ ਨੂੰ ਆਪਾਂ ਵਧੀਆ ਘਰੇ ਆਰਾਮ ਨਾਲ ਲਾ ਸਕਦੇ ਹੈ ਅਤੇ ਇਹ ਪੌਦੇ ਵਧੀਆ ਚਲਦੇ ਨੇ ਗਰਮੀਆਂ ਦੇ ਪੌਦਿਆਂ ਦੇ ਵਿੱਚ ਵੀ ਜਿੱਦਾਂ ਕਿ ਆਪਾਂ ਕੱਦੂ ਹੋ ਗਿਆ ਤੌਰੀਆਂ ਹੋ ਗਈਆਂ ਇਹ ਗਰਮੀਆਂ ਦੇ ਵਿੱਚ ਪੌਦੇ ਲਾਏ ਜਾਂਦੇ ਨੇ ਤੁਹਾਨੂੰ ਇਹਨਾਂ ਚੀਜ਼ਾਂ ਘਰੇ ਲਗਾਉਣ 'ਚ ਕੋਈ ਦਿੱਕਤ ਨਹੀਂ ਹੈ ਵਧੀਆ ਘਰੇ ਵਧੀਆ ਚੱਲਣਗੇ ਇਹ ਪੌਦੇ ਘਰੇ ਲਾਏ ਜਾਂਦੇ ਇਹ ਇਹਨਾਂ ਨੂੰ ਵੀ ਘਰੇ ਆਪਾਂ ਰੂਟੀਨ 'ਚ ਜਿਹੜੀ ਆਪਾਂ ਚਾਹ ਪਾਉਂਦੇ ਹਾਂ ਪੀਂਦੇ ਉਹਦੀ ਚਾਹ ਪੱਤੀ ਹੁੰਦੀ ਹੈ ਇਸ ਨੂੰ ਆਪਾਂ ਸਾਫ ਪਾਣੀ 'ਚੋਂ ਕੱਢ ਕੇ ਉਸ ਨੂੰ ਆਪਾਂ ਸੁਕਾ ਕੇ ਅਤੇ ਇਹਨਾਂ ਪੌਦਿਆਂ ਦੇ ਉੱਤੇ ਛਿੜਕ ਸਕਦੇ ਹਾਂ ਇਹਨਾਂ ਦੇ ਨਾਲ ਵੀ ਵਧੀਆ ਪੌਦੇ ਵਧੀਆ ਗ੍ਰੋਥ ਕਰਦੇ ਇਹ ਬਹੁਤ ਵਧੀਆ ਖਾਦ ਹੁੰਦੀ ਹੈ ਜੀ ਇਹਨਾਂ ਦੀ ਦੇਖਭਾਲ ਐ ਜੀ ਆ ਅਗਰ ਆਪਾਂ ਕੋਈ ਵੱਡਾ ਪੌਦਾ ਲਾਨੇ ਹਾਂ ਤਾਂ ਉਹ ਸਾਉਣ ਦੇ ਮਹੀਨੇ 'ਤੇ ਸਟਾਰਟਿੰਗ ਹੁੰਦੀ ਹੈ ਉਹ ਪੌਦੇ ਨੂੰ ਆਪਾਂ ਵਧੀਆ ਲਾ ਸਕਦੇ ਹੋ ਉਦੋਂ ਉਸ ਤੋਂ ਪੌਦੇ ਦੀ ਵਧੀਆ ਗਰੋਥ ਹੁੰਦੀ ਹੈ ਅਤੇ ਉਦਾਂ ਰੂਟੀਨ ਦੇ ਵਿੱਚ ਜਿੱਦਾਂ ਆਪਾਂ ਕੋਈ ਵੀ ਸਬਜ਼ੀਆਂ ਵਗੈਰਾ ਜਾਂ ਕੋਈ ਹੋਰ ਆਪਾਂ ਫੁੱਲ ਵਗੈਰਾ ਦਾ ਪੌਦਾ ਲਾਨੇ ਹਾਂ ਉਹ ਚੀਜ਼ਾਂ ਵੀ ਘਰੇ ਆਪਾਂ ਲਾ ਸਕਦੇ ਹਾਂ ਜਿੱਦਾਂ ਕਿ ਨਿੰਬੂ ਦਾ ਪੌਦਾ ਅਮਰੂਦ ਦਾ ਪੌਦਾ ਹੈ ਇਹ ਚੀਜ਼ਾਂ ਵੀ ਆਪਾਂ ਘਰੇ ਲਾ ਸਕਦੇ ਹਾਂ ਕਰੇਲੇ ਇਹ ਆਪਣੇ ਗਰਮੀਆਂ ਦੇ ਵਿੱਚ ਲਾਏ ਜਾਂਦੇ ਨੇ ਇਹ ਪੌਦੇ ਵਧੀਆ ਗਰੋਥ ਕਰਦੇ ਨੇ ਜੀ ਠੀਕ ਹੈ ਜੀ